ਮੇਰੇ ਦੰਦ ਵਿੱਚ ਬੜੇ ਦਿਨਾਂ ਤੋਂ ਦਰਦ ਹੋ ਰਿਹਾ ਹੈ ਜੋ ਕਿ ਲਗਾਤਾਰ ਵੱਧਦਾ ਜਾ ਰਿਹਾ ਹੈ ਹੁਣ ਮੈਨੂੰ ਡਾਕਟਰ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜਿਸ ਨੂੰ ਕਿ ਮੈਂ ਆਪਣਾ ਦੰਦ ਦਿਖਾ ਸਕਾਂ ਕਿਉਂਕਿ ਦਰਦ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਜੋ ਕਿ ਆਮ ਘਰੇਲੂ ਟੋਟਕਿਆਂ ਨਾਲ ਵੀ ਠੀਕ ਨਹੀਂ ਹੋ ਰਿਹਾ ਜੋ ਕਿ ਮੈਂ ਲੌਂਗ ਦੇ ਤੇਲ ਦਾ ਇਸਤੇਮਾਲ ਕੀਤਾ ਸੀ ਜਿਸ ਨਾਲ ਤਿੰਨ ਜਾਂ ਚਾਰ ਦਿਨ ਤੱਕ ਮੈਨੂੰ ਆਰਾਮ ਰਿਹਾ ਪਰ ਹੁਣ ਇਹੀ ਦਰਦ ਮੈਨੂੰ ਬਹੁਤ ਤੰਗ ਕਰ ਰਿਹਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਕਿਸੇ ਚੰਗੇ ਜਿਹੇ ਡਾਕਟਰ ਨੂੰ ਦਿਖਾ ਕੇ ਆਵਾਂ ਮੇਰਾ ਦਰਦ ਬਰਦਾਸ਼ਤ ਤੋਂ ਬਾਹਰ ਹੈ ਜਿਸ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਕਿਸੇ ਨਜ਼ਦੀਕੀ ਡਾਕਟਰ ਕੋਲ ਹੀ ਚਲੀ ਜਾਵਾਂ ਇਸਦੇ ਲਈ ਮੈਂ ਨਕਸ਼ੇ ਦੀ ਅਰਜ਼ੀ ਦੀ ਵਰਤੋਂ ਕਰਾਂਗੀ ਅਤੇ ਆਪਣੇ ਘਰ ਦੇ ਨੇੜੇ ਕਿਸੇ ਡਾਕਟਰ ਦੇ ਕਲੀਨਿਕ ਦਾ ਪਤਾ ਲਗਾਵਾਂਗੀ ਮੈਂ ਉੱਥੇ ਸਮੇਂ ਸਿਰ ਪਹੁੰਚ ਜਾਵਾਂਗੀ ਤਾਂ ਕਿ ਮੇਰੇ ਦੰਦਾਂ ਦੀ ਦਰਦ ਦਾ ਇਲਾਜ ਛੇਤੀ ਤੋਂ ਛੇਤੀ ਸ਼ੁਰੂ ਹੋ ਸਕੇ ਅਤੇ ਇਸ ਦੇ ਲਈ ਮੈਂ ਨਕਸ਼ੇ ਵਿੱਚੋਂ ਸਭ ਤੋਂ ਨੇੜੇ ਦੇ ਡਾਕਟਰ ਦਾ ਪਤਾ ਕਰਦੀ ਹਾਂ ਅਤੇ ਉਸ ਵਿੱਚੋਂ ਫੋਨ ਨੰਬਰ ਪਤਾ ਕਰਕੇ ਡਾਕਟਰ ਨੂੰ ਕਾਲ ਕਰਦੀ ਹਾਂ ਡਾਕਟਰ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਉਹ ਆਪਣੇ ਕਲੀਨਿਕ 'ਤੇ ਹੀ ਹਨ ਅਤੇ ਉਹਨਾਂ ਨੇ ਮੈਨੂੰ ਜਲਦੀ ਕਲੀਨਿਕ ਆਉਣ ਲਈ ਕਿਹਾ ਕਲੀਨਿਕ 'ਤੇ ਜਾਣ ਲਈ ਮੈਂ ਘਰ ਤੋਂ ਹੀ ਗੱਡੀ ਬੁੱਕ ਕੀਤੀ ਜੋ ਕਿ ਸਮੇਂ ਸਿਰ ਮੇਰੇ ਕੋਲ ਪਹੁੰਚ ਗਈ ਅਤੇ ਨਕਸ਼ੇ ਦੇ ਅਨੁਸਾਰ ਕਲੀਨਿਕ ਬਾਰੇ ਮੈਂ ਡਰਾਈਵਰ ਨੂੰ ਦੱਸਿਆ ਅਤੇ ਉਸਨੇ ਮੈਨੂੰ ਸਮੇਂ 'ਤੇ ਡਾਕਟਰ ਕੋਲ ਪਹੁੰਚਾ ਦਿੱਤਾ ਜਿਸ ਨੇ ਨਾਲ ਦੀ ਨਾਲ ਮੇਰਾ ਇਲਾਜ ਸਹੀ ਢੰਗ ਨਾਲ ਕਰ ਦਿੱਤਾ